ਜ਼ਿੰਦਗੀ ਵਿੱਚ ਕਲਾ ਦੀ ਅਹਿਮੀਅਤ ਇਸ ਲਈ ਹੈ ਤਾਂ ਕਿ ਹਰ ਇੱਕ ਦੇ ਵਿੱਚ ਰੱਬ ਨੇ ਗੁਣ ਪਾਏ ਹੋਏ ਹ ਸਨ ਕਿ ਅਸੀ ਲੋਕਾਂ ਨੂੰ ਦਿਖਾਈਏ ਅਤੇ ਆਪਣੇ ਅੰਦਰ ਦਾ ਕੋਨਫੀਡੈਂਸ ਆਪਣਾ ਜਗਾਈਏ ਕਿ ਹਾਂ ਅਸੀਂ ਕੁਛ ਕਰ ਸਕਦੇ ਹਾਂ ਰੱਬ ਨੇ ਦੁਨੀਆ 'ਚ ਭੇਜਿਆ ਵਾ ਕਿ ਕੁਛ ਦਿਖਾਉਣ ਲਈ ਭੇਜਿਆ ਸਾਡੇ ਚ ਇੱਦਾਂ ਤਾਂ ਹੋ ਨਹੀਂ ਸਕਦਾ ਕੁਛ ਕਲਾ ਨਾ ਦਿੱਤੀ ਹੋਏ ਰੱਬ ਨੇ ਹਰ ਇੱਕ ਦੇ ਵਿੱਚ ਕੋਈ ਨਾ ਕੋਈ ਗਿਣ ਗੁਣ ਦਿੱਤੇ ਹਨ ਜਿਸ ਨਾਲ ਜਿਹੜੀ ਕਲਾ ਰੱਬ ਨੇ ਦਿੱਤੀ ਆ ਅਤੇ ਅਸੀਂ ਕਰਦੇ ਹਾਂ ਸਾਨੂੰ ਖੁਸ਼ੀ ਮਿਲਦੀ ਹਾਂ ਅਤੇ ਅਸੀਂ ਇੰਡੀਪੈਂਡੈਂਟ ਹੁੰਦੇ ਹਾਂ ਅਸੀਂ ਪੈਸੇ ਕਮਾਉਂਦੇ ਹਾਂ ਸਾਡੇ ਪੇਰੈਂਟਸ ਨੂੰ ਵੀ ਸਾਡੇ 'ਤੇ ਪਰਾਊਡ ਹੁੰਦਾ ਆ ਕਿ ਹਾਂ ਸਾਡਾ ਬੱਚਾ ਕੁਛ ਕਰਦਾ ਆ ਜਿਸ ਨਾਲ ਮੰਨ ਮਨ ਤਾਂ ਖੁਸ਼ ਹੁੰਦਾ ਹੀ ਆ ਅਤੇ ਆਪਣੇ ਘਰਦਿਆਂ ਦਾ ਵੀ ਅਸੀਂ ਨਾਮ ਕਈ ਤਾਂ ਆ ਸਾਡੀ ਕਲਾ ਇੰਨੀ ਅੱਗੇ ਚੱਲ ਜਾਂਦੀ ਹੈ ਅਸੀਂ ਇੰਨੇ ਫੇਮਸ ਹੋ ਜਾਂਦੇ ਹਾਂ ਕਈ ਵਾਰ ਤਾਂ ਕਈ ਲੋਕ ਮੈਂ ਦੇਖੇ ਸਨ ਜਿਸ ਨਾਲ ਮਾਂ ਬਾਪ ਦਾ ਨਾਮ ਉੱਚਾ ਅਸੀਂ ਸਾਰਾ ਕੁਛ ਕਰ ਸਕਦੇ ਹਾਂ ਜਿਸ ਨਾਲ ਸਭ ਕੁਝ ਮਿਲਦਾ ਹੈ ਸਾਨੂੰ ਕਲਾ ਉਸ ਚੀਜ਼ ਹੈ ਉਹ ਚੀਜ਼ ਹੈ ਜਿੰਨਾਂ ਸਾਨੂੰ ਬਹੁਤ ਮਦਦ ਮਿਲਦੀ ਹੈ ਅਤੇ ਸਾਡੇ ਘਰਦਿਆਂ ਨੂੰ ਵੀ ਪਤਾ ਲੱਗਦਾ ਕਿ ਹਾਂ ਬੱਚਾ ਕੁਛ ਕਰ ਸਕਦਾ ਅਸੀਂ ਖੁਦ ਕਮਾ ਸਕਦੇ ਹਾਂ ਅਸੀਂ ਇੰਡੀਪੈਂਡੈਂਟ ਹਾਂ ਇਸ ਲਈ ਸਾਨੂੰ ਕਲਾ ਸਾਡੀ ਇਸ ਤਰ੍ਹਾਂ ਮਦਦ ਕਰ